ਹਾਂਜੀ ਸਤਿ ਸ਼੍ਰੀ ਅਕਾਲ ਕਿਆ ਹਾਲ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਸਬਜ਼ੀਆਂ ਭਾਅ ਜੀ ਗੋਭੀ ਮਟਰ ਗਾਜਰ ਮੂਲੀ ਸ਼ਲਗਮ ਘੀਆ ਬੈਂਗਣ ਪੱਤਾ ਗੋਭੀ ਤਾਂ ਹੈਗੀ ਆ ਜੀ ਮਸ਼ਰੂਮ ਨਹੀਂ ਜੀ ਹੈ ਹਲੇ ਨਾ ਨਾ ਬਾਈ ਔਰਗੈਨਿਕ ਆ ਜੀ ਸਾਰੀਆਂ ਕੋਈ ਦਵਾਈ ਨਹੀਂ ਕੋਈ ਦਵਾਈ ਦਾ ਛਿੜਕਾ ਨਹੀਂ ਹੈਗਾ ਬਾਈ ਆਪਾਂ ਲੋੜ ਅਨੁਸਾਰ ਪੱਟ ਰਹੇ ਹਾਂ ਬਸ ਪੱਟ ਕੇ ਆਪਾਂ ਨਾਲ ਦੀ ਨਾਲ ਮੰਡੀ ਵਗੈਰਾ ਜਾਂ ਫਿਰ ਆਪਣੇ ਸਟੋਰ 'ਤੇ ਲਿਆਉਂਦੇ ਹਾਂ ਅਤੇ ਪਾਣੀ ਵਗੈਰਾ ਰੱਖਦੇ ਪਾਣੀ ਵਗੈਰਾ ਮਾਰ ਮਾਰ ਕੇ ਰੱਖਦੇ ਹਾਂ ਪਰ ਕੋਈ ਉਹ ਨਹੀਂ ਯੂਸ ਕਰਦੇ ਹੈਗੇ ਫਰਟੀਲਾਈਜ਼ਰ ਵਗੈਰਾ ਨਹੀਂ ਨਹੀਂ ਨਹੀਂ ਨਹੀਂ ਭਾਅ ਜੀ ਬਾਕੀ ਤੁਸੀਂ ਸਟੋਰ 'ਤੇ ਕਰ ਲਿਓ ਗੱਲ ਆ ਕੇ ਰੇਟਾਂ ਰੁੱਟਾਂ ਦੀ ਤਾਂ ਹਾਂਜੀ ਠੀਕ ਆ ਠੀਕ ਆ ਤੁਸੀਂ ਸੁਣਾਓ ਘਰ ਪਰਿਵਾਰ ਠੀਕ ਹੈ ਹਾਂਜੀ ਬਰੋਕਲੀ ਵੀ ਹੈਗੀ ਆ ਜੀ ਬਰੋਕਲੀ ਹੈਗੀ ਆ ਜੀ ਪੱਤਾ ਗੋਭੀ ਗੋਭੀ ਵਾਲਾ ਫੁੱਲ ਟਮਾਟਰ ਨਹੀਂ ਜੀ ਹੈਗੇ ਬਾਕੀ ਪਿਆਜ਼ ਆਲੂ ਬੈਂਗਣ ਅਤੇ ਆਪਣਾ ਧਨੀਆ ਮੈਨੀ ਮੋਰ ਆ ਜੀ ਬਹੁਤ ਸਾਰੀਆਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ